ਜਿਵੇਂ ਕਿ ਮੈਂ ਆਪਣੀ ਆਉਣ ਵਾਲੀ ਯਾਤਰਾ ਦੀ ਤਿਆਰੀ ਕਰ ਰਿਹਾ ਮੇਰੀਆਂ ਮੁੱਖ ਚਿੰਤਾਵਾਂ ਵਿੱਚੋਂ ਇੱਕ ਇਹ ਯਕੀਨੀ ਬਣਾਉਣਾ ਹੈ ਕਿ ਮੇਰੇ ਕੋਲ ਨੈਵੀਗੇਸ਼ਨ 'ਤੇ ਜੁੜੇ ਰਹਿਣ ਲਈ ਢੁਕਵਾਂ ਡਾਟਾ ਹੈਗਾ ਮੈਂ ਜੀਪੀਐਸ ਨੈਵੀਗੇਸ਼ਨ ਲਈ ਆਪਣੇ ਸਮਾਰਟ ਫੋਨ 'ਤੇ ਬਹੁਤ ਜ਼ਿਆਦਾ ਭਰੋਸਾ ਕਰਦਾ ਜਿਸ ਲਈ ਬਹੁਤ ਜ਼ਿਆਦਾ ਡਾਟਾ ਦੀ ਲੋੜ ਹੁੰਦੀ ਹੈ ਖਾਸ ਕਰਕੇ ਜੇਕਰ ਮੈਂ ਅਣਜਾਣ ਖੇਤਰਾਂ ਦੀ ਯਾਤਰਾ ਕਰ ਰਿਹਾ ਹਾਂ ਜਾਂ ਰੀਅਲ ਟਾਈਮ ਅਪਡੇਟ ਵਰਤੋਂ ਕਰ ਰਿਹਾ ਹਾਂ ਇਸ ਤੋਂ ਇਲਾਵਾ ਯੋਜਨਾਵਾਂ ਦਾ ਤਾਲਮੇਲ ਬਣਾਉਣ ਅਤੇ ਦੋਸਤਾਂ ਪਰਿਵਾਰ ਦੇ ਸੰਪਰਕ ਵਿੱਚ ਰਹਿਣ ਲਈ ਮੈਸੇਜ ਐਪਸ ਦੁਆਰਾ ਜੁੜੇ ਰਹਿਣਾ ਅਤੇ ਈਮੇਲਾਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ ਮੈਂ ਇਹ ਦੇਖਣ ਲਈ ਆਪਣੇ ਬੀਮਾ ਪ੍ਰਦਾਤਾ ਨਾਲ ਆਪਣੀ ਡਾਟਾ ਦੀ ਵਰਤੋਂ 'ਤੇ ਚਰਚਾ ਕਰਨ ਬਾਰੇ ਵਿਚਾਰ ਕਰ ਰਿਹਾ ਹਾਂ ਕੀ ਕੋਈ ਯਾਤਰਾ ਯੋਜਨਾਵਾਂ ਜਾਂ ਵਿਕਲਪ ਹਨ ਜੋ ਵਿਦੇਸ਼ ਵਿੱਚ ਬਿਹਤਰ ਕਵਰੇਜ ਜਾਂ ਵਾਧੂ ਡਾਟਾ ਭੱਤੇ ਦੀ ਪੇਸ਼ਕਸ਼ ਕਰ ਸਕਦੇ ਹਨ ਇਹ ਪੁਸ਼ਟੀ ਕਰਨਾ ਮਹੱਤਵਪੂਰਨ ਹੈ ਕਿ ਮੇਰਾ ਮੌਜੂਦਾ ਪਲਾਨ ਲੋੜੀਂਦਾ ਅੰਤਰਰਾਸ਼ਟਰੀ ਡਾਟਾ ਪ੍ਰਦਾਨ ਕਰਦਾ ਹੈ ਜਾਂ ਮੈਨੂੰ ਇੱਕ ਅਸਥਾਈ ਅਪਗਰੇਡ ਜਾਂ ਯਾਤਰਾ ਵਿਸ਼ੇਸ਼ ਡਾਟਾ ਪਲਾਨ ਵਿੱਚ ਦੇਖਣਾ ਚਾਹੀਦਾ ਹੈ ਮੈਂ ਆਪਣੀ ਯਾਤਰਾ ਦੌਰਾਨ ਕਿਸੇ ਵੀ ਅਣਕਿਆਸੇ ਖਰਚੇ ਜਾਂ ਕਨੈਕਟਿਵਿਟੀ ਵਿੱਚ ਰੁਕਾਵਟਾਂ ਤੋਂ ਬਚਣਾ ਚਾਹੁੰਦਾ ਹਾਂ ਭਰੋਸੇਯੋਗ ਡਾਟਾ ਅਕਸੈਸ ਹੋਣ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਮੈਂ ਕੁਸ਼ਲਤਾ ਨਾਲ ਨੈਵੀਗੇਟ ਕਰ ਸਕਦਾ ਹਾਂ ਅਤੇ ਆਪਣੀ ਯਾਤਰਾ ਦੌਰਾਨ ਜੁੜਿਆ ਰਹਿ ਸਕਦਾ ਹਾਂ